ਅ ਅੱਜ ਕੱਲ੍ਹ ਟੈਕਨੋਲਜੀ ਨੇ ਟਰਾਂਸਪੋਰਟ ਨੂੰ ਕਾਫ਼ੀ ਅਸਾਨ ਬਣਾ ਦਿੱਤਾ ਹੈ ਅਸੀਂ ਟੈਕਨੋਲਜੀ ਨਾਲ ਕੁਝ ਵੀ ਅਸਾਨੀ ਨਾਲ ਪਤਾ ਕਰ ਸਕਦੇ ਲੈਂਦੇ ਹਾਂ ਜਿਵੇਂ ਅਸੀਂ ਕਿਸੇ ਸਫ਼ਰ 'ਤੇ ਜਾਣਾ ਹੁੰਦਾ ਹੈ ਤਾਂ ਅਸੀਂ ਔਨਲਾਇਨ ਹੀ ਟਿਕਟ ਬੁੱਕ ਕਰਵਾ ਸਕਦੇ ਹਾਂ ਅਤੇ ਘਰ ਬੈਠੇ ਹੀ ਦੇਖ ਅਪ ਕਰ ਸਕਦੇ ਹਾਂ ਭਾਵੇਂ ਟ੍ਰੇਨ ਬੱਸ ਕਾਰ ਹਵਾਈ ਯਾਤਰਾ ਇਹਨਾਂ ਸਭ ਕੁਝ ਬੁੱਕ ਕਰ ਸਕਦੇ ਹਾਂ ਅਸੀਂ ਜਿੱਥੇ ਜਾਣਾ ਹੈ ਅਸੀਂ ਔਨਲਾਇਨ ਹੋਟਲ ਵੀ ਬੁੱਕ ਕਰ ਸਕਦੇ ਹਾਂ ਜਾਂ ਟੈਕਨੋਲਜੀ ਦੀ ਮਦਦ ਨਾਲ ਔਨਲਾਇਨ ਯਾਤਰਾ ਦਾ ਪਤਾ ਵੀ ਕਰ ਸਕਦੇ ਹਾਂ ਜਾਂ ਕਿਸੇ ਪਲੇਟਫਾਰਮ ਨੰਬਰ ਜਾਂ ਸਟੇਸ਼ਨ ਜਾਂ ਕਿਸੇ ਬੱਸ ਸਟੋਪ ਸਥਾਨ ਬਾਰੇ ਜਾਣਕਾਰੀ ਇਸ ਦੀ ਮਦਦ ਨਾਲ ਅਸਾਨੀ ਨਾਲ ਲੈ ਸਕਦੇ ਹਾਂ